ਬਾਈਕਿੰਗ ਸ਼ੁਰੂ ਕਰਨ ਲਈ ਮੈਂ ਜਦੋਂ ਵੀ ਕਿਸੇ ਨੂੰ ਹੋਰ ਨੂੰ ਬਾਈਕ ਚਲਾਉਂਦਾ ਦੇਖਦਾ ਸੀ ਤਾਂ ਮੇਰੇ ਮਨ ਵਿੱਚ ਵੀ ਆਉਂਦਾ ਸੀ ਕਿ ਮੈਂ ਵੀ ਬਾਈਕ ਚਲਾਵਾਂ ਫਿਰ ਮੈਂ ਇੱਕ ਦਿਨ ਮੇਰੇ ਨਾਲ ਇੱਕ ਵਿਲੱਖਣ ਘਟਨਾ ਹੋਈ ਘਰਦੇ ਬਿਮਾਰ ਹੋ ਗਏ ਉਹਨਾਂ ਨੂੰ ਦਵਾਈ ਦਵਾਉਣੀ ਸੀ ਡਾਕਟਰ ਦੀ ਦੁਕਾਨ ਸਾਡੇ ਪਿੰਡ ਤੋਂ ਕਾਫੀ ਦੂਰ ਸੀ ਸਾਡੇ ਘਰ ਬਾਈਕ ਤਾਂ ਸੀ ਪਰ ਚਲਾਉਣ ਵਾਲਾ ਕੋਈ ਨਹੀਂ ਸੀ ਮੈਨੂੰ ਚਲਾਉਣਾ ਨਹੀਂ ਆਉਂਦੀ ਸੀ ਬਾਈਕ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਫਿਰ ਮੈਂ ਸੋਚ ਲਿਆ ਕਿ ਮੈਂ ਬਾਈਕ ਸਿੱਖਣੀ ਹੀ ਸਿੱਖਣੀ ਹੈ ਫਿਰ ਮੈਂ ਹੌਲੀ ਹੌਲੀ ਸਾਈਕਲ ਚਲਾਉਣਾ ਸ਼ੁਰੂ ਕੀਤਾ ਸਾਈਕਲ ਚਲਾਉਣ ਤੋਂ ਬਾਅਦ ਮੈਨੂੰ ਜਦੋਂ ਪੂਰੀ ਤਰ੍ਹਾਂ ਸਾਈਕਲ ਚਲਾਉਣਾ ਆ ਗਿਆ ਫਿਰ ਮੈਂ ਬਾਈਕ ਚਲਾਉਣੀ ਸਿੱਖੀ ਮੈਂ ਹੌਲੀ ਹੌਲੀ ਚਲਾਉਂਦਾ ਗਿਆ ਬਾਈਕ ਕੁਝ ਹੀ ਦਿਨਾਂ ਦੇ ਵਿੱਚ ਮੈਂ ਬਾਈਕ ਚਲਾਉਣੀ ਸਿੱਖ ਗਿਆ ਇਸ ਲਈ ਮੈਂ ਬਾਈਕ ਸ਼ੁਰੂ ਕਰਨ ਲਈ ਪ੍ਰੇਰਿਤ ਹੋਇਆ ਫਿਰ ਮੈਂ ਬਾਈਕ ਚਲਾਉਣ ਲਈ ਟੈਸਟ ਦੇ ਕੇ ਆਇਆ ਆਪਣੀ ਬਾਈਕ ਦਾ ਡਰਾਈਵਿੰਗ ਲਾਇਸੈਂਸ ਬਣਾਇਆ ਜੋ ਸਾਡੇ ਬਹੁਤ ਵਧੀਆ ਬਾਈਕ ਨੂੰ ਹਮੇਸ਼ਾਂ ਹੀ ਚਾਲ੍ਹੀ ਤੋਂ ਪੰਤਾਲੀ ਜਾਂ ਪੰਜਾਹ ਦੀ ਸਪੀਡ 'ਤੇ ਹੀ ਚਲਾਉਣਾ ਚਾਹੀਦਾ ਹੈ ਕਿਉਂ ਕਰਕੇ ਇੱਕ ਤਾਂ ਬਾਈਕ ਐਵਰੇਜ ਜ਼ਿਆਦਾ ਦਿੰਦੀ ਹੈ ਦੂਸਰਾ ਬਾਈਕ ਦੀ ਸਾਂਭ ਸੰਭਾਲ ਰਹਿੰਦੀ ਹੈ ਇਹ ਜਲਦੀ ਖਰਾਬ ਨਹੀਂ ਹੁੰਦੀ ਇਸ ਕਰਕੇ ਬਾਈਕ ਨੂੰ ਹਮੇਸ਼ਾਂ ਹੀ ਹੌਲੀ ਸਪੀਡ 'ਤੇ ਚਲਾਓ ਇਸ ਨਾਲ ਆਪਣਾ ਵੀ ਅਤੇ ਕਿਸੇ ਹੋਰ ਦਾ ਵੀ ਨੁਕਸਾਨ ਨਹੀਂ ਹੁੰਦਾ ਹੈ